ਮੌਜੂਦਾ ਸਮੇਂ ਦੇ ਵਿੱਚ ਵਿਗਿਆਪਨ ਦੇ ਬਹੁਤ ਸਾਰੇ ਤਰੀਕੇ ਨੇ ਅਤੇ ਅਲੱਗ ਅਲੱਗ ਤਰੀਕੇ ਅਲੱਗ ਅਲੱਗ ਲੋਕਾਂ ਵੱਲੋਂ ਯੂਜ ਕਰੇ ਜਾਂਦੇ ਨੇ ਅਤੇ ਜਿਵੇਂ ਆਪਾਂ ਮੇਨਲੀ ਗੱਲ ਕਰੀਏ ਤਾਂ ਅਖਬਾਰ ਹੋ ਗਿਆ ਅਖਬਾਰਾਂ ਵਿੱਚ ਲੋਕ ਮਸ਼ਹੂਰੀ ਦਿੰਦੇ ਨੇ ਆਪਣੇ ਪ੍ਰੋਡਕਟ ਦੀ ਅਤੇ ਇਸ ਤੋਂ ਇਲਾਵਾ ਪੈਪਲੇਟ ਹੋ ਗਈ ਪੈਂਪਲੇਟ ਬਣਵਾਉਂਦੇ ਨੇ ਅਤੇ ਹਰ ਥਾਂ 'ਤੇ ਜਾ ਕੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾਂ ਦਸ ਕਿਲੋਮੀਟਰ ਦੇ ਨੇੜੇ ਦੇ ਏਰੀਏ ਦੇ ਵਿੱਚ ਉਹ ਆਪਣੇ ਪੈਂਪਲੇਟਸ ਲਗਾਉਂਦੇ ਨੇ ਅਤੇ ਇਹ ਤੋਂ ਇਲਾਵਾ ਉਹ ਟੀਵੀ 'ਤੇ ਐਡ ਵੀ ਦਿੰਦੇ ਨੇ ਵਿਗਿਆਪਨ ਦੇ ਲਈ ਅਤੇ ਇਹ ਤੋਂ ਇਲਾਵਾ ਹੋਰ ਜਿਵੇਂ ਨਵੇਂ ਸਾਧਨ ਆ ਗਏ ਨੇ ਅੱਜ ਦੇ ਜ਼ਮਾਨੇ ਵਿੱਚ ਵਿਗਿਆਪਨ ਦੇ ਜਿਵੇਂ ਆਪਾਂ ਸੋਸ਼ਲ ਮੀਡੀਆ ਯੂਜ ਕਰਦੇ ਹਾਂ ਸੋਸ਼ਲ ਮੀਡੀਆ 'ਤੇ ਆਪਾਂ ਵਟਸਐਪ ਦੀ ਗੱਲ ਕਰਦੇ ਹਾਂ ਵਟਸਐਪ ਅੱਜ ਦੇ ਟਾਈਮ ਦੇ ਵਿੱਚ ਹਰ ਪਰਸਨ ਯੂਜ਼ ਕਰਦੇ ਆ ਵਟਸਐਪ 'ਤੇ ਸਟੇਟਸ ਦੁਆਰਾ ਜਾਂ ਆਪਣੇ ਵਟਸਐਪ ਗਰੁੱਪਸ ਦੇ ਵਿੱਚ ਆਪਾਂ ਉਹ ਜਾਣਕਾਰੀ ਸ਼ੇਅਰ ਕਰ ਸਕਦੇ ਹਾਂ ਅਤੇ ਲੋਕਾਂ ਤੱਕ ਉਹ ਪਹੁੰਚਦੀ ਹੈ ਅਤੇ ਲੋਕ ਉਸ ਚੀਜ਼ 'ਤੇ ਧਿਆਨ ਵੀ ਦਿੰਦੇ ਨੇ ਅਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਖਬਾਰ ਜਾਂ ਪੈਂਪਲੇਟ ਤਾਂ ਕੋਈ ਹੀ ਪਰਸਨ ਪੜਦਾ ਹੋਊਗਾ ਬਟ ਜੋ ਸੋਸ਼ਲ ਮੀਡੀਆ ਉਹ ਹਰ ਪਰਸਨ ਯੂਜ ਕਰਦਾ ਆ ਅਤੇ ਇਹ ਕੀ ਆ ਇੱਕ ਬਹੁਤ ਇਫੈਕਟਿਵ ਤਰੀਕਾ ਆ ਸੋਸ਼ਲ ਮੀਡੀਆ ਦੁਆਰਾ ਆਪਣਾ ਜਿਹੜਾ ਸੰਦੇਸ਼ ਆ ਉਹ ਪਹੁੰਚਾਉਣ ਦਾ ਇਸ ਤੋਂ ਇਲਾਵਾ ਇੰਸਟਾਗਰਾਮ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਚੱਲ ਰਿਹਾ ਹੈ ਜਿਹਦੇ 'ਤੇ ਲੋਕ ਜ਼ਿਆਦਾਤਰ ਆਪਣੀ ਪੋਸਟ ਸਟੋਰੀ ਪਾ ਕੇ ਦਿਓ ਪੋਸਟ ਨੂੰ ਬੂਸਟ ਕਰਵਾ ਕੇ ਹੈ ਨਾ ਇੰਸਟਾਗ੍ਰਾਮ ਤੋਂ ਆਪਣਾ ਵਿਗਿਆਪਨ ਦਿੰਦੇ ਨੇ ਇਸ ਤਰ੍ਹਾਂ ਜੋ ਇਸ਼ਤਿਹਾਰ ਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਰਹੇ ਨੇ ਮਤਲਬ ਲੋਕਾਂ ਨੂੰ ਰਿਜਲਟ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਆ ਰਹੇ ਨੇ ਅਤੇ ਮੈਂ ਸਭ ਤੋਂ ਪ੍ਰਭਾਵਸ਼ਾਲੀ ਦੇ ਰਤਨਾਤਮਕ ਤਰੀਕੇ ਦੀ ਗੱਲ ਕਰਾਂ ਤਾਂ ਉਹ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਹੀ ਆ ਆਪਾਂ ਨੂੰ ਹਰੇਕ ਪਰਸਨ ਚਾਹੇ ਉਹ ਛੋਟਾ ਹੋਵੇ ਹੈ ਨਾ ਅਠਾਰਾਂ ਸਾਲ ਤੋਂ ਘੱਟ ਉਮਰ ਦਾ ਹੋਵੇ ਅਠਾਰਾਂ ਸਾਲ ਤੋਂ ਵੱਧ ਹੋਵੇ ਜਾਂ ਆਪਾਂ ਪੰਜਾਹ ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੀ ਗੱਲ ਕਰੀਏ ਆਪਾਂ ਨੂੰ ਸਾਰੇ ਪਰਸਨ ਸੋਸ਼ਲ ਮੀਡੀਆ 'ਤੇ ਅੱਜ ਦੇ ਟਾਈਮ ਦੇ ਵਿੱਚ ਮਿਲ ਜਾਣਗੇ ਅਤੇ ਹਰੇਕ ਘਰ ਦੇ ਵਿੱਚ ਆਪਾਂ ਨੂੰ ਇੱਕ ਸਮਾਰਟ ਫੋਨ ਜ਼ਰੂਰ ਮਿਲ ਜਾਊਗਾ ਅਤੇ ਮੈਨੂੰ ਸਭ ਤੋਂ ਵਧੀਆ ਤਰੀਕਾ ਸਾ ਸੋਸ਼ਲ ਮੀਡੀਆ ਦੁਆਰਾ ਆਪਣੀ ਜਾਣਕਾਰੀ ਦੇਣਾ ਹੀ ਸਭ ਤੋਂ ਜ਼ਿਆਦਾ ਵਧੀਆ ਲੱਗਦਾ